ਹੈਲੋ ਸਤਿ ਸ਼੍ਰੀ ਅਕਾਲ ਜੀ ਆਪਣਾ ਢਾਬਾ ਤੋਂ ਬੋਲ ਰਹੇ ਹੋ ਜੀ ਹਾਂਜੀ ਮੈਂ ਥੋੜ੍ਹੀ ਦੇਰ ਪਹਿਲਾਂ ਆਪਣਾ ਢਾਬਾ 'ਤੇ ਔਡਰ ਲਿਖਵਾਇਆ ਸੀਗਾ ਸੈਕਟਰ ਨਾਈਨ ਨਾਈਟੀ ਨਾਈਨ ਤੋਂ ਦੋ ਕੜਾਹੀ ਪਨੀਰ ਦੋ ਦਾਲ ਮੱਖਣੀ ਇੱਕ ਰਾਇਤਾ ਅਤੇ ਪੰਜ ਫੁਲਕਿਆਂ ਦਾ ਅਤੇ ਉਸ ਸਮੇਂ ਮੈਂ ਕਿਸੇ ਹੋਰ ਫਲੈਟ ਵਿੱਚ ਮੌਜੂਦ ਸੀ ਪਰ ਹੁਣ ਮੈਨੂੰ ਕਿਸੇ ਐਮਰਜੈਂਸੀ ਕਾਰਨ ਨਾਲ ਦੇ ਬਲੋਕ ਦੇ ਵਿੱਚ ਜਾਣਾ ਪੈ ਗਿਆ ਕਿਰਪਾ ਕਰਕੇ ਜਿਹੜਾ ਮੇਰਾ ਔਡਰ ਹੈ ਨਾਲ ਦੇ ਬਲੋਕ ਵਿੱਚ ਮੈਂ ਤੁਹਾਨੂੰ ਐਡਰੈੱਸ ਭੇਜਣ ਲੱਗੀ ਹਾਂ ਉੱਥੇ ਭੇਜਣ ਦੀ ਕ੍ਰਿਪਾਲਤਾ ਕਰੋ ਅਤੇ ਬਹੁਤ ਵਧੀਆ ਲੱਗੇਗਾ ਕਿਉਂਕਿ ਮੈਂ ਤੁਹਾਡੇ ਢਾਬੇ ਤੋਂ ਅੱਗੇ ਵੀ ਜਿਹੜੇ ਔਡਰ ਨੇ ਉਹ ਕਰਦੀ ਰਹਿੰਦੀ ਹਾਂ ਅਤੇ ਇੱਕ ਹੋਰ ਗੱਲ ਮੈਂ ਆਪਣਾ ਜਿਹੜਾ ਕੈਸ਼ ਹੈ ਉਹ ਮੈਂ ਘਰ ਭੁੱਲ ਆਈ ਅਤੇ ਇਸ ਕਰਕੇ ਮੇਰੇ ਕੋਲ ਕਾਰਡ ਹੈ ਤੁਸੀਂ ਆਪਣਾ ਬਾਰਕੋਰਡ ਭੇਜ ਦਿਓ ਅਤੇ ਮੈਂ ਉਹਦੇ ਰਾਹੀਂ ਤੁਹਾਡੀ ਜਿਹੜੀ ਡਿਲੀਵਰੀ ਹੈ ਉਹ ਕਰ ਦਊਂਗੀ ਥੈਂਕ ਯੂ